ਹੈਲੋ ਹਾਂਜੀ ਕੌਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਿਲਜੂ ਹਾਂਜੀ ਬੋਲੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਦੀ ਜਿਹੜੀ ਆਪਣੀ ਧਰਤੀ ਹੋਈ ਪਹਿਲਾਂ ਤਾਂ ਵੀ ਪੰਜ ਦਰਿਆਵਾਂ ਦੀ ਧਰਤੀ ਹੈਗੀ ਹੈ ਪੰਜ ਦਰਿਆਵਾਂ ਦੀ ਧਰਤੀ ਸੀਗੀ ਹੁਣ ਤਾਂ ਵੀ ਤਿੰਨ ਹੀ ਰਹਿ ਗਏ ਇੱਥੇ ਸਤਲੁਜ ਰਾਵੀ ਅਤੇ ਬਿਆਸ ਇਹ ਤਿੰਨ ਹੀ ਰਹਿਗੇ ਜਿਹੜੇ ਹੁਣ ਸਤਲੁਜ ਅਤੇ ਬਿਆਸ ਹੈ ਇਹ ਹੈਗੇ ਹੈ ਇਹ ਹਿਮਾਚਲ ਤੋਂ ਚਲਦੇ ਹੈਗੇ ਹੈ ਅਤੇ ਹੌਲੀ ਹੌਲੀ ਰੋਪੜ ਆਹਾ ਹਰੀ ਕੇ ਪੱਤਣ ਆਹਦੇ ਵਿੱਚੋਂ ਤੋਂ ਨਿਕਲਦੇ ਹੈਗੇ ਹਨ ਅਤੇ ਹਾਂਜੀ ਜਿਹੜੀ ਰਾਵੀ ਹੈਗੀ ਆ ਉਹ ਥੋੜ੍ਹਾ ਜਿਹਾ ਘੱਟ ਵਗਦੀ ਹੈ ਅਤੇ ਸਤਲੁਜ ਇਹ ਜ਼ਿਆਦੇ ਜ਼ਿਆਦੇ ਮਤਲਬ ਤੱਕ ਲੈ ਕੇ ਜਾਨੀ ਇਹ ਜ਼ਿਆਦਾ ਹਾਂਜੀ ਇੰਨਾਂ ਕ ਜ਼ਿਆਦਾ ਠੀਕ ਹੈ ਅਤੇ ਹਾਂਜੀ ਹਾਂਜੀ ਉਹਦਾ ਐਂ ਹੈਗਾ ਵੀ ਹਾਂ ਪਾਣੀ ਨੂੰ ਪਤਾ ਕੀ ਪਾਣੀ ਦੀ ਅੱਜ ਅੱਜ ਕੱਲ੍ਹ ਤਾਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ ਜਿਵੇਂ ਕੋਈ ਫੰਕਸ਼ਨ ਹੁੰਦੇ ਆ ਉੱਥੇ ਵੀ ਜ਼ਿਆਦਾ ਵੇਸਟ ਕਰਦੇ ਹੈ ਪਾਣੀ ਪੀਂਦੇ ਘੱਟ ਆ ਅਤੇ ਵੇਸਟ ਜ਼ਿਆਦਾ ਕਰਦੇ ਜਿਵੇਂ ਹੁਣ ਆਪਾਂ ਕੱਪੜੇ ਹੀ ਧੌਣ ਲੱਗ ਗਏ ਉਹ ਉੱਥੇ ਵੀ ਲੇਡੀਜ਼ ਜ਼ਿਆਦਾ ਵੇਸਟ ਕਰਦੀਆਂ ਉਹ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ ਹਨ ਬਚਾਉਣਾ ਚਾਹੀਦਾ ਐ ਏ ਏ ਇਸ ਤਰ੍ਹਾਂ ਦਾ ਵੀ ਤੁਸੀਂ ਵਾਟਰ ਪਾਣੀ ਨੂੰ ਬਚਾਉਣ ਵਾਸਤੇ ਵੀ ਤੁਸੀਂ ਅਖਬਾਰ ਦੇ ਵਿੱਚ ਛਾਪ ਸਕਦੇ ਹੋ ਕੋਲਮ ਬਣਾ ਕੇ ਇੱਕ ਕਈ ਤਰ੍ਹਾਂ ਨਾਲ ਜੇ ਕੋਈ ਲੋਕ ਅੰਟਰਸਟਿੰਗ ਚੀਜ਼ ਅੰਟਰਸਟਿੰਗ ਤਰ੍ਹਾਂ ਨਾਲ ਜਿਹੜੇ ਵੀ ਸਾਰੇ ਲੋਕ ਪੜ੍ਹ ਸਕਣ ਅਤੇ ਉਹਦੀ ਆਹਾ ਪਾਣੀ ਦੀ ਦੁਰਵਰਤੋਂ ਕਰਨ ਤੋਂ ਬਚਣ ਅਤੇ ਇਸ ਨੂੰ ਸਾਫ ਵੀ ਪਾਣੀ ਨੂੰ ਸਾਫ ਵੀ ਰੱਖਿਆ ਜਾਵੇ ਜਿਵੇਂ ਫੈਕਟਰੀਆਂ ਜਿਵੇਂ ਆਪਣੇ ਆਪ ਹੀ ਜਿਵੇਂ ਹੁਣ ਆਪਣੇ ਨੇੜੇ ਕੋਈ ਘਰਾਂ ਦੇ ਕੋਈ ਕੋਈ ਕੱਚੀ ਲੱਗਦੀ ਹੁੰਦੀ ਹੈ ਜਾਂ ਕੋਈ ਵੀ ਹੁੰਦਾ ਆਪਾਂ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਕੂੜਾ ਸਿੱਟਦੇ ਆ ਆਪਾਂ ਕਹਿੰਦੇ ਅਤੇ ਅਸੀਂ ਗਾਹਾਂ ਲੰਘ ਜਾਂਦੇ ਪਰ ਜਿਹੜਾ ਗਾਹਾਂ ਜਾਂਦਾ ਉਹ ਵੀ ਪ੍ਰਦੂਸ਼ਣ ਗਾਹਾਂ ਦੀ ਗਾਹਾਂ ਜਾਈ ਜਾਂਦਾ ਰਹਿੰਦਾ ਉਹ ਫਿਰ ਨਾਲ ਪਾਣੀ ਪ੍ਰਦੂਸ਼ਿੁਤ ਪ੍ਰਦੂਸ਼ਿਤ ਹੋ ਜਾਂਦਾ ਹਮ ਹਮ ਤੁਸੀਂ ਪਰ ਹਾਂ ਹਮ ਹਮ ਹਮ ਹਾਂ ਹਾਂ ਅਤੇ ਹਾਂ ਪਾਣੀ ਬਾਰੇ ਵੀ ਤੁਸੀਂ ਇੱਕ ਇੱਦਾਂ ਕਰਨਾ

ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਜ਼ਿਆਦਾਤਰ ਮਦਦ ਕਰ ਸਕਦੇ ਹੋ ਉਹਦੇ ਵਿੱਚ